ਹਾਂਜੀ ਪਰਿਵਾਰ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਦੀ ਬਹੁਤ ਹੀ ਅਹਿਮ ਭੂਮਿਕਾ ਹੈ ਅਸਲ ਵਿੱਚ ਇਹਨਾਂ ਦਾ ਕੋਈ ਵਜੂਦ ਹੀ ਨਹੀਂ ਆਦਮੀ ਤੋਂ ਬਿਨਾ ਔਰਤ ਦਾ ਅਤੇ ਔਰਤ ਤੋਂ ਬਿਨਾ ਆਦਮੀ ਦਾ ਅਸਲ ਵਿੱਚ ਜਦੋਂ ਇਹਨਾਂ ਦਾ ਮਿਲਣ ਹੁੰਦਾ ਹੈ ਆਦਮੀ ਅਤੇ ਔਰਤ ਦਾ ਤਾਂ ਹੀ ਦੂਸਰਾ ਪਰਿਵਾਰਕ ਮੈਂਬਰ ਆਉਂਦਾ ਹੈ ਇਸ ਕਰਕੇ ਇਹਨਾਂ ਦੀ ਪਰਿਵਾਰ ਵਿੱਚ ਅਹਿਮ ਭੂਮਿਕਾ ਹੈ ਇਹ ਇੱਕ ਪਰਿਵਾਰ ਨੂੰ ਬੰਨ ਕੇ ਰੱਖਦੇ ਹਨ ਜੋੜ ਕੇ ਰੱਖਦੇ ਹਨ ਆਪਣੇ ਬੱਚਿਆਂ ਨੂੰ ਆਪਣੇ ਹੋਰ ਆਲ਼ੇ ਦੁਆਲ਼ੇ ਨੂੰ ਇਹ ਜੋੜ ਕੇ ਰੱਖਦੇ ਹਨ ਇਹ ਆਪਣੇ ਕੰਮਕਾਰ ਨੂੰ ਆਪਸ ਵਿੱਚ ਵੰਡ ਲੈਂਦੇ ਹਨ ਪਰ ਮਰਦ ਨੇ ਬਾਹਰ ਦਾ ਕੰਮ ਕਰਨਾ ਹੁੰਦਾ ਹੈ ਜਿਵੇਂ ਕਿ ਬਾਹਰ ਦੀ ਰੋਜ਼ੀ ਰੋਟੀ ਵਾਸਤੇ ਇੱਕ ਪੈਸਾ ਕਮਾਉਣਾ ਅਤੇ ਜਿਹੜੀ ਔਰਤ ਹੁੰਦੀ ਹੈ ਉਹ ਆਪਣੇ ਘਰ ਦਾ ਕੰਮ ਕਰਦੀ ਹੈ ਕੰਮ ਕਾਜ ਕਰਦੀ ਹੈ ਬੱਚਿਆਂ ਨੂੰ ਸਾਂਭਣਾ ਪੜ੍ਹਾਉਣਾ ਲਿਖਾਉਣਾ ਨਵਾਉਣਾ ਧਵਾਉਣਾ ਇਸ ਤਰ੍ਹਾਂ ਦੇ ਕੰਮ ਜਿਹੜਾ ਕਿ ਮਰਦ ਹੈ ਉਹ ਬਾਹਰ ਦੇ ਕੰਮ ਜ਼ਿਆਦਾ ਕਰਦਾ ਹੈ ਰੋਜ਼ੀ ਰੋਟੀ ਵਾਸਤੇ ਪੈਸੇ ਕਮਾਉਂਦਾ ਹੈ ਕਿਰਤ ਕਰਦਾ ਹੈ ਇਹ ਇਹਨਾਂ ਦੀਆਂ ਭੂਮਿਕਾਵਾਂ ਬਹੁਤ ਵਿਕਸਿਤ ਹੋਈਆਂ ਹਨ ਇਹਨਾਂ ਤੋਂ ਬਿਨਾ ਵਜੂਦ ਹੀ ਨਹੀਂ ਇਹ ਇਸ ਤਰ੍ਹਾਂ ਹੀ ਚੱਲਦੇ ਹਨ